ਸਤਿ ਸ਼੍ਰੀ ਅਕਾਲ ਸਰ ਅਸੀਂ ਜਾਣਦੇ ਹਾਂ ਕਿ ਸਾਡੇ ਇਲਾਕੇ ਵਿੱਚ ਪਰ ਸਾਡੇ ਇਲਾਕੇ ਵਿੱਚ ਐਸੀ ਬਹੁਤ ਸਾਰੇ ਪੰਛੀ ਦੇਖੇ ਜਾਂਦੇ ਹਨ ਇੱਲ ਤੋਤਾ ਚਿੜੀ ਮੋਰ ਇਹ ਤੋਤਾ ਦਰਖਤਾਂ ਦੇ ਵਿੱਚ ਆਪਣੀ ਚੁੰਝ ਦੇ ਨਾਲ ਖੁੰਡ ਕੇ ਆਲ੍ਹਣਾ ਤਿਆਰ ਕਰ ਲੈਂਦਾ ਹੈ ਜਿਹੜੀ ਚਿੜੀ ਚਿੜੀ ਆਪ ਬਾਹਰੋਂ ਫਿਰ ਤੁਰ ਕੇ ਘਾਹ ਇਕੱਠਾ ਕਰਕੇ ਆਪਣਾ ਘਾਹ ਹੈ ਆਲ੍ਹਣਾ ਬਣਾ ਲੈਂਦੀ ਹੈ ਇੱਲ ਆਪਣੇ ਆ ਅਤੇ ਬਹੁਤ ਵੱਡੀਆਂ ਝਾੜੀਆਂ ਦੇ ਵਿੱਚ ਆਲ੍ਹਣੇ ਬਣਾ ਲੈਂਦੀ ਹੈ ਇਹਨਾਂ ਜਾਨਵਰਾਂ ਨੂੰ ਅਸੀਂ ਜਾਣਦੇ ਹਾਂ ਕਿ ਇਹਨਾਂ ਤੋਂ ਸਾਨੂੰ ਬਹੁਤ ਹੀ ਦੇਖ ਕੇ